ਪੰਜ ਅਪ੍ਰੈਲ ਉੱਨੀ ਸੌ ਨੱਬੇ ਤਿੰਨ ਅਕਤੂਬਰ ਅਠਾਰ੍ਹਾਂ ਸੌ ਅੱਸੀ ਤੇਰ੍ਹਾਂ ਨਵੰਬਰ ਸੋਲ੍ਹਾਂ ਸੌ ਸੱਤਰ ਦਸ ਦਸੰਬਰ ਸ ਸਤਾਰ੍ਹਾਂ ਸੌ ਪੰਝੱਤਰ ਛੇ ਅਗਸਤ ਅਠਾਰ੍ਹਾਂ ਸੌ